ਪ੍ਰੈਸ ਦੀ ਆਜ਼ਾਦੀ ਅੱਜ ਕੱਲ੍ਹ ਦੇ ਸਰਮਾਏਦਾਰਾਂ ਵਿਅਕਤੀਆਂ ਦੇ ਹੱਥ ਵਿੱਚ ਹੈ ਅਤੇ ਜਾਂ ਰਾਜਨੀਤਿਕ ਪਾਰਟੀਆਂ ਦੇ ਹੱਥ ਵਿੱਚ ਜੋ ਦਿਖਾਉਣਾ ਚਾਹੁੰਦੇ ਹਨ ਦਿਖਾਉਂਦੇ ਹਨ ਜੋ ਨਹੀਂ ਦਿਖਾਉਣਾ ਉਸ ਨੂੰ ਪੈਸੇ ਦੇ ਜ਼ੋਰ ਨਾਲ ਦਬਾਅ ਦਿੱਤਾ ਜਾਂਦਾ ਹੈ ਅੱਜ ਕੱਲ੍ਹ ਦੀਆਂ ਸਾਰੀਆਂ ਖਬਰਾਂ ਵਿੱਚ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਅਤੇ ਨਾ ਸਮਝੀ ਵਾਲੀ ਗੱਲ ਹੈ ਇਸ ਦਾ ਕਾਰਨ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ